ਟੈਲੀਫੋਨ ਟੈਕਨੋਲਜੀ ਅੱਜ ਕੱਲ੍ਹ ਬਥੇਰਾ ਇਹ ਟੈਲੀਕਾਮ ਟੈਕਨੋਲਜੀ ਇਹਦੇ ਨਾਲ ਤਾਂ ਬਹੁਤ ਸੁਖਾਲਾ ਹੋ ਗਿਆ ਜਿਵੇਂ ਪਹਿਲਾਂ ਲੋਕ ਚਿੱਠੀਆਂ ਪਾਉਂਦੇ ਸੀਗੇ ਦੂਰ ਦੂਰ ਚਿੱਠੀ ਹਫਤਾ ਹਫਤਾ ਦੋ ਦੋ ਹਫਤੇ ਨਹੀਂ ਆਉਂਦੀ ਸੀ ਕਈ ਵਾਰ ਤਾਂ ਮਹੀਨਾ ਵੀ ਪੈ ਜਾਂਦਾ ਸੀ ਪਰ ਇਹ ਟੈਲੀਫੋਨ ਦੇ ਕਰਕੇ ਤਾਂ ਲੋਕਾਂ ਨੂੰ ਚਿੱਠੀਆਂ ਤੋਂ ਰਾਹਤ ਮਿਲੀ ਹੈ ਲੋਕ ਦੂਰ ਦੁਰਾਡੇ ਬੈਠੇ ਟੈਲੀਫੋਨ ਨਾਲ ਜਿਵੇਂ ਮਰਜ਼ੀ ਗੱਲ ਕਰ ਸਕਦੇ ਆ ਜਿੱਥੇ ਮਰਜ਼ੀ ਗੱਲ ਕਰ ਲੈਣ ਅੱਜ ਕੱਲ੍ਹ ਯੁੱਗ ਵੀ ਇਲੈਕਟਰੋਨਿਕਸ ਦਾ ਹੈਗਾ ਏ ਟੈਕਨੋਲਜੀ ਦਾ ਟੈਕਨੋਲਜੀ ਹੈਗਾ ਟੈਕਨੋਲਜੀ ਕਰਕੇ ਟੈਕਨੋਲਜੀ ਕਰਕੇ ਬਹੁਤ ਕੁਝ ਟੈਕਨੋਲਜੀ ਕਰਕੇ ਬਹੁਤ ਕੁਛ ਵਰਤਿਆਂ ਹੈ ਜਿਵੇਂ ਟੈਬ ਹੋ ਗਏ ਲੈਪਟਾਪ ਹੋ ਗਏ ਮੋਬਾਈਲ ਹੋ ਗਏ ਇਹ ਸਾਰਾ ਟੈਕਨੋਲਜੀ ਦਾ ਹੀ ਸਿਸਟਮ ਹੈ ਟੈਕਨੋਲਜੀ ਕਰਕੇ ਤਾਂ ਬਥੇਰਾ ਕੁਛ ਬਦ ਬਦਲ ਚੁੱਕਿਆ ਲੋਕ ਦੂਰ ਦੁਰਾਡੇ ਬੈਠੇ ਇਹਨਾਂ ਨਾਲ ਗੱਲ ਕਰ ਸਕਦੇ ਆ ਜਿਵੇਂ ਮਰਜ਼ੀ ਗੱਲ ਕਰ ਲੈਣ ਟੈਕਨੋਲਜੀ ਨੇ ਤਾਂ ਬਹੁਤ ਕੁਛ ਟੈਕਨੋਲਜੀ ਨੇ ਤਾਂ ਬਹੁਤ ਕੁਛ ਦਿੱਤਾ ਸਾਰਾ ਕੰਮ ਹੀ ਟੈਲੀਫੋਨ 'ਤੇ ਹੁੰਦਾ ਜਿਹੜਾ ਕੰਮ ਮਰਜ਼ੀ ਕਰ ਲਓ ਜੋ ਕੰਮ ਆਪਾਂ ਘਰ ਬੈਠੇ ਕੁਛ ਵੀ ਔਡਰ ਕਰਨਾ ਹੈ ਫੋਨ ਘੁੰਮਾਓ ਚਲੋ ਜੀ ਔਡਰ ਕੀਤਾ ਕੋਈ ਵੀ ਚੀਜ਼ ਖਾਣੀ ਹੈ ਫੋਨ ਘੁੰਮਾਓ ਚਲੋ ਜੀ ਔਡਰ ਕੀਤਾ ਚੀਜ਼ ਘਰ ਆ ਗਈ ਘਰ ਬੈਠਿਆਂ ਨੂੰ ਸਭ ਕੁਛ ਮਿਲ ਜਾਂਦਾ ਇਹ ਟੈਕਨੋਲੋਜੀ ਤਾਂ ਆਪਾਂ ਨੂੰ ਬਹੁਤ ਵਧੀਆ ਇਹਨੇ ਲੋਕਾਂ ਨੂੰ ਬਹੁਤ ਤਸਵੀਰ ਦਿੱਤੀ ਹੈ ਲੋਕ ਜਿੰਨੇ ਮਰਜ਼ੀ ਆਪਣਾ ਗੂਗਲ ਪੇ ਕਰ ਦਿਓ ਉਹ ਵੀ ਟੈਕਨੋਲੋਜੀ ਕਰਕੇ ਆ